ਦੌੜਨ ਜਾਂ ਬਾਕ ਕਰਨ ਲਈ ਮੇਰੀ ਸਭ ਤੋਂ ਮਨਪਸੰਦ ਜਗ੍ਹਾ ਸਾਡੇ ਸ ਕਨਾਲ ਦੇ ਨਾਲ ਨਾਲ ਬਣਿਆ ਹੋਇਆ ਰਸਤਾ ਹੈ ਜੋ ਕਿ ਤਕਰੀਬਨ ਇੱਕ ਸਾਈਡ ਜਾਈਏ ਤਾਂ ਦੋ ਢਾਈ ਕਿਲੋਮੀਟਰ ਦੇ ਕਰੀਬ ਬਣਦਾ ਹੈ ਪਰ ਜੇ ਜਾਣ ਆਉਣ ਵਾਪਸ ਉਹ ਪੰਜ ਕਿਲੋਮੀਟਰ ਹੋ ਜਾਂਦਾ ਉਸ ਰਸਤੇ ਦੇ ਉੱਪਰ ਮੈਂ ਅਤੇ ਮੇਰਾ ਇੱਕ ਦੋਸਤ ਜੋ ਮੇਰਾ ਕਲਾਸਮੇਟ ਵੀ ਸੀ ਅਸੀਂ ਦੋਨੇ ਰੋਜ਼ਾਨਾ ਉਸ ਰਸਤੇ ਦੇ ਉੱਪਰ ਦੋ ਜਾਂ ਤਿੰਨ ਚੱਕਰ ਲਗਾਉਂਦੇ ਹਾਂ ਜਿਸ ਦੇ ਨਾਲ ਇੱਕ ਸਰੀਰ ਨੂੰ ਨਵੀਂ ਊਰਜਾ ਮਿਲਦੀ ਹੈ ਜਿਵੇਂ ਕਿ ਕਹਿੰਦੇ ਹੁੰਦੇ ਹਨ ਵਗਦੇ ਹੋਏ ਪਾਣੀ ਦੇ ਨਾਲ ਸੈਰ ਕਰਨ ਨਾਲ ਸਰੀਰ ਨੂੰ ਇੱਕ ਅਜੀਬ ਹੀ ਫੁਰਤੀ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਹ ਰਸਤਾ ਇਸ ਕਰਕੇ ਵੀ ਸਾਡੇ ਮਨਪਸੰਦ ਹੈ ਕਿਉਂਕਿ ਉੱਧਰ ਕਿਸੇ ਵੀ ਪ੍ਰਕਾਰ ਦੇ ਕਿਸੇ ਵਾਹਨ ਦੀ ਕੋਈ ਆਵਾਜਾਈ ਨਹੀ ਹੈਗੀ ਜਿਸ ਨਾਲ ਉਸ ਰਸਤੇ ਦੇ ਉੱਤੇ ਸ਼ਾਂਤਮਈ ਮਾਹੌਲ ਬਣਿਆ ਰਹਿੰਦਾ ਹੈ ਛਾਉਣੀ ਦੇ ਨਾਲ ਉਹ ਇਲਾਕਾ ਲੱਗਣ ਕਾਰਨ ਉੱਥੇ ਬਹੁਤ ਜ਼ਿਆਦਾ ਦਰਖਤ ਹਨ ਉਹ ਦਰਖਤ ਉਸ ਇਲਾਕੇ ਦੇ ਵਿੱਚ ਹੋਰ ਵੀ ਜ਼ਿਆਦਾ ਪ੍ਰਭਾਵ ਪਾਉਂਦੇ ਹਨ ਛੁੱਟੀ ਵਾਲੇ ਦਿਨ ਅਸੀਂ ਘੱਟੋ ਘੱਟ ਇੱਕ ਘੰਟਾ ਉਸ ਰਸਤੇ ਦੇ ਉੱਪਰ ਚਲਦੇ ਹਾਂ ਅਤੇ ਅਤੇ ਇੱਥੇ ਜਾ ਕੇ ਅਖੀਰ ਦੇ ਉੱਪਰ ਇੱਕ ਲੋਹੇ ਦਾ ਪੁਲ ਬਣਿਆ ਹੋਇਆ ਹੈ ਜਿਸ ਦੇ ਉੱਪਰ ਬੈਠ ਕੇ ਅਸੀਂ ਤਕਰੀਬਨ ਅੱਧਾ ਪੌਣਾ ਘੰਟਾ ਕਸਰਤ ਕਰਦੇ ਹਾਂ ਅਤੇ ਗੱਲਾਂ ਬਾਤਾਂ ਵੀ ਹੁੰਦੀਆਂ ਹਨ ਇਸ ਕਰਕੇ ਵੀ ਉਹ ਹੋਰ ਮਾਹੌਲ ਖੂਬਸੂਰਤ ਹੁੰਦਾ ਹੈ ਉੱਥੇ ਕਿਉਂਕਿ ਆਸੇ ਪਾਸੇ ਜਿਹੜੇ ਖੇਤ ਹਨ ਉਹਨਾਂ ਖੇਤਾਂ ਦੇ ਵਿੱਚ ਲਹਿ ਲਹਾਉਂਦੀਆਂ ਫਸਲਾਂ ਉੱਥੋਂ ਦੇ ਮਾਹੌਲ ਨੂੰ ਹੋਰ ਵੀ ਰੌਚਕ ਬਣਾਉਂਦੀਆਂ ਹਨ ਅਤੇ ਮੈਂ ਅਤੇ ਮੇਰਾ ਦੋਸਤ ਤਕਰੀਬਨ ਪਿਛਲੇ ਦਸ ਸਾਲਾਂ ਤੋਂ ਇਕੱਠੇ ਉਸ ਰਸਤੇ 'ਤੇ ਸੈਰ ਕਰ ਰਹੇ ਹਾਂ